ਪਹਿਲਾਂ ਤੋਂ ਕਾਫੀ ਬਿਹਤਰ ਹੋ ਗਿਆ ਮਤਲਬ ਕਿ ਪਹਿਲਾਂ ਜਿਵੇਂ ਪੰਜਾਬੀ ਲੋਕ ਟੈਕਨੋਲੋਜੀ ਨਾਲ ਉਹਨਾਂ ਦਾ ਥੋੜ੍ਹਾ ਫਾਸਲਾ ਸੀਗਾ ਬਟ ਹੁਣ ਇੱਦਾਂ ਹੋ ਗਿਆ ਕਿ ਉਹ ਹੌਲੀ ਹੌਲੀ ਕਰਕੇ ਅਡੋਪਟ ਕਰ ਰਿਹਾ ਨਵੀਂ ਨਵੀਂ ਟੈਕਨੋਲੋਜੀਸ ਨੂੰ ਉਹ ਇਨਫੈਕਟ ਆਪਣੇ ਜਿਹੜੇ ਐਗਰੀਕਲਚਰ ਵਿੱਚ ਆ ਉਦੋਂ ਉੱਥੇ ਵੀ ਵੱਖ ਵੱਖ ਤਰੀਕੇ ਦੀਆਂ ਟੈਕਨੋਲਜੀ ਸੈਕਟਰ 'ਚ ਆਏ ਨਵੇਂ ਨਵੇਂ ਗੈਜਟਸ ਯੂਜ ਕਰ ਰਹੇ ਜਿਸ ਕਰਕੇ ਉਹਨਾਂ ਦਾ ਕੰਮ ਬਹੁਤ ਸੌਖਾ ਹੋ ਰਿਹਾ ਹਾਂ ਮੈਂ ਇਹ ਨਹੀਂ ਕਹਿ ਸਕਦੀ ਕਿ ਉਹ ਪੂਰੀ ਤਰੀਕੇ ਨਾਲ ਅਡੈਪ ਕਰ ਚੁੱਕੇ ਹਨ ਟੈਕਨੋਲੋਜੀ ਨੂੰ ਨਵੀਂ ਟੈਕਨੋਲੋਜੀ ਨੂੰ ਬਟ ਕਾਫੀ ਹੱਦ ਤੱਕ ਉਹਨਾਂ ਨੂੰ ਫਰਕ ਕਾਫੀ ਕਾਫੀ ਜ਼ਿਆਦਾ ਜਿਹੜੀ ਨਵੀਂ ਨਵੀਆਂ ਟੈਕਨੋਲਜੀਆਂ ਹਨ ਉਹ ਯੂਜ਼ ਕਰ ਰਿਹਾ ਜਿਸ ਕਰਕੇ ਉਹਨਾਂ ਨੂੰ ਦਿਨਚਰਿਆ ਦੇ ਕੰਮ ਵਿੱਚ ਬਹੁਤ ਸੌਖਾ ਹੋ ਰਿਹਾ ਹੈ ਅਤੇ ਉਹਨਾਂ ਦਾ ਕੰਮ ਬਹੁਤ ਆਸਾਨੀ ਨਾਲ ਅਤੇ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ